ਹੈਲੋ ਹਾਂਜੀ ਸਰ ਇੱਕ ਕੰਪਲੇਂਟ ਸੀ ਵਿਲੇਜ ਪਮੋਰ ਤਹਿਸੀਲ ਬੱਸੀ ਪਠਾਣਾ ਡਿਸਟਰਿਕਟ ਫਤਿਹਗੜ੍ਹ ਸਾਹਿਬ ਦੋ ਸੌ ਛਪੰਜਾ ਨੰਬਰ ਹੈ ਜੀ ਆਪਣਾ ਹਾਂ ਹਾਂ ਉਹਦੇ 'ਚ ਇਹ ਹੈ ਵੀ ਪਾਣੀ ਖ਼ਰਾਬ ਆ ਰਿਹਾ ਜੀ ਟੂਟੀ 'ਚ ਉਹਨੂੰ ਕਰਾਓ ਜੀ ਠੀਕ ਇਹ ਤਕਰੀਬਨ ਪਿਛਲੇ ਵਨ ਮੰਥ ਤੋਂ ਪਹਿਲਾਂ ਵੀ ਮੈਂ ਦੋ ਵਾਰ ਕਰ ਚੁੱਕਿਆ ਕੰਪਲੇਂਟ ਅੱਛਾ ਹੋਰ ਠੀਕ ਠੀਕ ਨਹੀਂ ਹੋਇਆ ਜੀ ਪਾਣੀ ਉਹਦੇ ਕਾਰਨ ਉਹਦੇ ਕਾਰਨ ਪੇਸ਼ੈਂਟ ਹੋ ਗਏ ਸੀ ਪਰ ਆਪਣੇ ਨਹੀਂ ਠੀਕ ਠੀਕ ਨਹੀਂ ਹੋਈ ਜੀ ਤਕਰੀਬਨ ਪਾਣੀ ਥੋੜ੍ਹਾ ਗੰਧਲਾ ਗੰਧਲਾ ਪਾਣੀ ਆ ਰਿਹਾ ਪਾਣੀ ਦਾ ਫਲੋ ਤਾਂ ਠੀਕ ਹੈ ਤਕਰੀਬਨ ਤਕਰੀਬਨ ਤਕਰੀਬਨ ਤਕਰੀਬਨ ਠੀਕ ਹੈ ਚਲੋ ਜਿੰਨੀ ਛੇਤੀ ਜਿੰਨੀ ਛੇਤੀ ਹੋ ਸਕਦਾ ਓਨੀ ਛੇਤੀ ਕਰਵਾਉ ਜੀ ਠੀਕ ਹੈ ਜੀ ਕਿੱਥੋਂ ਕਰੀਏ ਜੀ ਭਰਾ ਕਰਦੇ ਹਾਂ ਜਿੰਨੀ ਛੇਤੀ ਹੋ ਸਕਦਾ ਤੁਸੀਂ ਇਧਰੋਂ ਕਰਵਾ ਦਿਉ ਜੀ ਡਿਪਾਰਟਮੈਂਟ ਤੋਂ ਜੀ ਜੀ ਜੀ ਜੀ ਜੀ ਥੈਂਕ ਥੈਂਕ ਯੂ ਥੈਂਕ ਯੂ ਓਕੇ